ਮੈਨੂੰ ਇੰਟਰਨੈਟ ਦੀ ਬੈਂਕ ਸੁਵਿਧਾ ਚੰਗੀ ਲੱਗਦੀ ਹੈ ਕਿਉਂਕਿ ਮੈਂ ਆਪਣੇ ਘਰ ਤੋਂ ਹੀ ਸਾਰੇ ਬੈਂਕ ਦੇ ਕੰਮ ਔਨਲਾਈਨ ਦੇ ਥਰੂ ਕਰ ਸਕਦਾ ਹਾਂ ਬੈਂਕ ਵਿੱਚ ਜਾਣ ਨਾਲ ਦਿੱਕਤਾਂ ਆਉਂਦੀਆਂ ਇੱਕ ਤਾਂ ਬੈਂਕ ਮੇਰੇ ਘਰ ਤੋਂ ਦੂਰ ਹੈ ਦੂਸਰਾ ਬੈਂਕ ਵਿੱਚ ਫਾਰਮੈਟੀ ਜਾ ਕੇ ਬਹੁਤ ਜ਼ਿਆਦਾ ਭਰਨੀਆਂ ਪੈਂਦੀਆਂ ਇਹ ਫਾਰਮ ਭਰੋ ਕਰੋ ਇੱਥੇ ਸਾਈਨ ਕਰੋ ਫਿਰ ਕਹਿੰਦੇ ਸਿਗਨੇਚਰ ਤੁਹਾਡੇ ਮੈਚ ਨਹੀਂ ਕਰ ਰਹੇ ਇਸ ਕਰਕੇ ਘਰ ਬੈਠੇ ਹੀ ਇੰਟਰਨੈਟ ਦੇ ਜਰੂ ਥਰੂ ਸਹੀ ਸ ਸਹੀ ਤਰੀਕੇ ਨਾਲ ਅਸੀਂ ਆਪਣਾ ਘਰ ਬੈਠੇ ਹੀ ਕੰਮ ਕਰ ਸਕਦੇ ਹਾਂ ਇਸ ਕਰਕੇ ਇੰਟਰਨੈਟ ਦੀ ਸੁਵਿਧਾ ਬੈਂਕ ਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਔਰ ਨਾਲੇ ਹੋਰ ਇੰਟਰਨੈਟ ਦੇ ਥਰੂ ਅਸੀਂ ਸਾਡਾ ਆਉਣ ਜਾਣ ਦਾ ਬੈਂਕ 'ਚ ਜਾਵਾਂਗੇ ਫਿਰ ਸਾਡਾ ਟਾਈਮ ਦੀ ਵੀ ਵੇਸਟ ਘਰ ਬੈਠੇ ਅਸੀਂ ਟਾਈਮ ਵੀ ਆਪਣਾ ਬਚਾਉਂਦੇ ਹਾਂ ਦੂਜਾ ਆਪਣੇ ਅਸੀਂ ਗੱਡੀ ਜਾਂ ਮੋਟਰਸਾਈਕਲ ਦੇ ਪੈਟਰੋਲ ਦੇ ਤੇਲ ਦੀ ਬੱਚਤ ਵੀ ਹੁੰਦੀ ਹੈ ਇਸ ਕਰਕੇ ਘਰ ਬਹਿ ਕੇ ਹੀ ਅਸੀਂ ਇੰਟਰਨੈਟ ਜ਼ਿਆਦਾ ਪੈਕਿੰਗ ਦਾ ਕੰਮ ਕਰਦੇ ਹਾਂ